ਹੈਲੋ ਹੈਲੋ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਹਾਂਜੀ ਹਾਂ ਵਧੀਆ ਤੁਸੀਂ ਸੁਣਾਓ ਜੀ ਕਿੱਦਾਂ ਹੈ ਠੀਕ ਹੈ ਜੀ ਹਾਂਜੀ ਥੋੜ੍ਹੀ ਜਿਹੀ ਇੰਨਫੋਰਮੇਸ਼ਨ ਲੈਣੀ ਜੀ ਸੀਗੀ ਹਾਂਜੀ ਜ ਹਰੀ ਕ੍ਰਾਂਤੀ ਆਈ ਹੈ ਉਹਦੇ ਵਿੱਚ ਕਕ ਕਿਆ ਪ੍ਰਭਾਵ ਪਿਆ ਹੈ ਜੀ ਪੰਜਾਬ ਵਿੱਚ ਫਸਲਾਂ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਅੱਛਾ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ

ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਹੋਰ ਇ ਇ ਇਹ ਨਾਲ ਸਾਡੀ ਇੰਨਕਮ ਕਿੱਦਾਂ ਇੰਨ ਇੰਨਕਮ 'ਤੇ ਪ੍ਰਭਾਵ ਕਿੱਦਾਂ ਪਿਆ ਕੋਈ ਹੈਗਾ ਜੀ ਲਾਭ ਹਾਨੀ ਕਿੱਦਾਂ ਹੈ ਜੀ

ਠੀਕ ਹੈ ਠੀਕ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਧੰਨ ਧੰਨਵਾਦ ਭਾਅ ਜੀ ਤੁਹਾਡਾ ਬਹੁਤ ਵਧੀਆ ਓਕੇ ਓਕੇ ਓਕੇ